ਹੈਲੋ ਤੁਸੀਂ ਭਾਅ ਜੀ ਕਿਹੜਾ ਲੈਣਾ ਚਾਹੋਗੇ ਐਂਡਰਾਇਡ ਕਿ ਦੂਸਰਾ ਆਈ ਫੋਨ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਅਤੇ ਐਂਡਰਾਇਡ ਦੇ ਵਿੱਚ ਦੇਖੋ ਤੁਹਾਨੂੰ ਮਾਡਲ ਮਿਲ ਵੀ ਜਾਣਗੇ ਕਿੰਨੀ ਕੁ ਰੇਂਜ ਆ ਤੁਹਾਡੀ ਐਂਡਰਾਇਡ ਵਿੱਚ ਕਿੰਨਾ ਕੁ ਖਰਚ ਲੂੰਗੇ ਤੁਸੀਂ ਲੱਖ ਤਾਂ ਫਿਰ ਤਾਂ ਬਹੁਤ ਵਧੀਆ ਫਿਰ ਤੁਸੀਂ ਦੇਖ ਲਓ ਸੈਮਸੰਗ ਦੇ ਸਾਡੇ ਕੋਲ ਵਧੀਆ ਵਧੀਆ ਫੋਨ ਆ ਜਾਣਗੇ ਸਾਰੇ ਉਹਨਾਂ ਵਿਚ ਪ੍ਰੋਸੈਸਰ ਵੀ ਲੇਟੈਸਟ ਪਿਆ ਜਿਵੇਂ ਏਟ ਜੈੱਡ ਟੂ ਹੁਣ ਲੇਟੈਸਟ ਪ੍ਰੋੋਸੈਸਰ ਚਲ ਰਿਹਾ ਅਤੇ ਇਹ ਪ੍ਰੋਸੈਸਰ ਕਾਫੀ ਤਕੜਾ ਅਤੇ ਤੇਜ਼ ਆ ਅਤੇ ਹਾਂਜੀ ਹਾਂਜੀ ਅਤੇ ਕੈਮਰਾ ਦੱਸਦਾ ਮੈਂ ਤੁਹਾਨੂੰ ਇਹਦੇ ਵਿੱਚ ਕੈਮਰਾ ਵੀ ਬਹੁਤ ਸੋਹਣੇ ਸੋਹਣੇ ਜਿਵੇਂ ਸੈਮਸੰਗ ਦਾ ਹੁਣ ਲੇਟੈਸਟ ਫੋਨ ਚੱਲ ਰਿਹਾ ਐੱਸ ਟਵੈਂਟੀ ਟੂ ਅਤੇ ਹਾਂਜੀ ਹਾਂਜੀ ਟਵੈਂਟੀ ਫੋ ਟਵੈਂਟੀ ਫੋਨ ਭਾਅ ਜੀ ਇੱਦਾਂ ਤੁਹਾਨੂੰ ਡੇਢ ਲੱਖ ਦਾ ਪੈ ਜਾਊਗਾ ਦੇਖ ਲਓ ਜੇ ਤਾਂ ਅਫੋਡ ਕਰ ਸਕਦੇ ਹੋ ਹਾਂਜੀ ਹਾਂਜੀ ਐੱਸ ਟਵੈਂਟੀ ਥ੍ਰੀ ਆਪਾਂ ਨੂੰ ਪਏਗਾ ਇੱਕ ਤੀਹ ਦਾ ਤੇ ਐੱਸ ਟਵੈਂਟੀ ਟੂ ਐੱਸ ਟਵੈਂਟੀ ਟੂ ਅਲਟਰਾ ਪੈ ਜਾਉ ਆਪਾਂ ਨੂੰ ਪੂਰਾ ਮਤਲਵ ਨੱਬੇ ਪਚਾਨਵੇਂ ਕੁ ਦਾ ਪੈ ਜਾਉਗਾ ਉਹ ਨੇੜੇ ਤੇੜੇ ਮੈਂ ਤਾਂ ਤੁਹਾਨੂੰ ਦੱਸਿਆ ਸੀਗਾ ਉਹ ਐਪਲ ਦੇ ਦੇਖੋ ਭਾਈ ਤੁਹਾਨੂੰ ਐਪਲ ਦਾ ਚੌਦਾਂ ਤੱਕ ਮਿਲ ਜਾਊਗਾ ਵਧੀਆ ਸੱਤਰ ਹਜ਼ਾਰ ਤੱਕ ਦਾ ਸੱਤਰ ਪੰਝੱਤਰ ਦਾ ਆਈ ਫੋਨ ਜੀ ਚੌਦਾਂ ਪਲੱਸ ਤੁਹਾਨੂੰ ਪੈ ਜਾਉ ਅੱਸੀ ਪਚਾਸੀ ਕੁ ਦਾ ਅਤੇ ਚੌਦਾਂ ਪਰੋ ਤੁਹਾਨੂੰ ਪੈ ਜਾਉਗਾ ਨੱਬੇ ਪਚਾਨਵੇਂ ਦਾ ਬਸ ਉੱਤੋਂ ਚੌਦਾਂ ਜਿਹੜਾ ਪਰੋ ਪਰੋ ਮੈਕਸ ਉਹ ਇੱਕ ਤੀਹ ਕੁ ਦਾ ਅਤੇ ਚੌਦਾਂ ਜਿਹੜਾ ਪਲੱਸ ਆ ਇਕੱਲਾ ਚੌਦਾਂ ਪਰੋ ਮੈਕਸ ਇਕੱਲਾ ਅਤੇ ਚੌਦਾਂ ਪਰੋ ਆ ਅਤੇ ਉਹ ਆਪਾਂ ਨੂੰ ਪੈ ਜਾਉ ਇੱਕ ਪੰਜ ਕੁਛ ਕੁ ਦਾ ਰੰਗ ਤੁਸੀਂ ਦੱਸੋ ਕਿਹੜਾ ਲੈਣਾ ਜੀ ਉਹਦੇ ਵਿੱਚ ਚਿੱਟਾ ਵੀ ਮਿਲ ਜਾਊਗਾ ਆਪਾਂ ਨੂੰ ਅਤੇ ਕਾਲਾ ਵੀ ਮਿਲ ਜਾਊਗਾ ਥੋੜ੍ਹਾ ਲਾਈਟ ਗਰੀਨ ਵੀ ਮਿਲ ਜਾਊਗਾ ਪਰਪਲ ਕਲਰ ਵੀ ਮਿਲ ਜਾਊਗਾ ਉਹਦੇ ਵਿੱਚ ਆਪਾਂ ਨੂੰ ਤੁਸੀਂ ਦੱਸੋ ਕਿੰਨੇ ਵਾਲਾ ਲਉਂਗੇ ਜੀ ਅ ਉਹਦਾ ਕਰ ਦਿੰਦੇ ਫਿਰ ਚੌਂਹਠ ਆਲ ਚੌਂਹਠ ਵਾਲੇ ਤਾਂ ਹੁਣ ਬਹੁਤ ਛੋਟਾ ਮਾਡਲ ਰਹਿ ਗਿਆ ਤੁਸੀਂ ਇੱਕ ਸੌ ਅਠਾਈ ਦੋ ਸੌ ਛਪੰਜਾ ਮਿਲ ਜੂਗਾ ਤੁਹਾਨੂੰ ਵਧੀਆ ਜੇ ਤੁਸੀਂ ਕਹੋ ਚੌਦਾਂ ਚੌਦਾਂ ਪਰੋ ਮੈਕਸ ਤੱਕ ਤੁਸੀਂ ਖਿੱਚਣਾ ਫਿਰ ਚੌਦਾਂ ਪਰੋ ਮੈਕਸ ਨਾ ਲਓ ਉਹੀ ਦੱਸਿਆ ਮੈਂ ਦੋ ਸੌ ਛਪੰਜਾ ਜੀ ਬੀ ਇੱਕ ਤੀਹ ਦਾ ਪੈ ਜਾਣਾ ਤੁਹਾਨੂੰ ਵਧੀਆ ਹਾਂਜੀ ਹਾਂਜੀ ਏ ਫੋਰਟੀਨ ਚਿੱਪ ਆਉਂਦੀ ਏ ਫੋਰਟੀਨ ਚਿੱਪ ਆਉਂਦੀ ਹੈ ਇਹਦੇ ਵਿਚ ਕਿਤੇ ਮਾਰ ਨਹੀਂ ਖਾਂਦਾ ਜੀ ਇਹ ਕੈਮਰਾ ਤੁਹਾਨੂੰ ਕੈਮਰਾ ਸੌਲਾਂ ਸਤਾਰਾਂ ਮੇਗਾ ਪਿਕਸਲ ਦੇ ਦਿੰਦਾ ਜੀ ਸਾਰੇ ਐਂਡਰਾਇਡ ਫੋਨਾਂ ਨਾਲੋਂ ਤਕੜਾ ਕੈਮਰਾ ਇਹਨਾਂ ਦਾ ਆਉਂਦਾ ਹਾਂਜੀ ਹਾਂਜੀ ਫੋਨ ਫੋਨ ਲੈ ਕੇ ਤੁਹਾਨੂੰ ਕੋਈ ਐਂਏ ਨਹੀਂ ਹੋਣਾ ਹੈਗਾ ਤੁਹਾਨੂੰ ਵੀ ਮਤਲਬ ਮਗਰ ਲੱਗਿਆ ਹੋਵੇ ਬਹੁਤ ਮਾੜੀ ਚੀਜ਼ ਲੈ ਲਈ ਤੁਸੀਂ ਪੂਰਾ ਐਨ ਕਰੋਗੇ ਵੀ ਵਧੀਆ ਲਿਆ ਫੋਨ ਹਾਂਜੀ ਹਾਂਜੀ ਚਲੋ ਠੀਕ ਆ ਭਾਅ ਜੀ ਦੋਨੋਂ ਮੈਂ ਔਡਰ ਕਰ ਦਿੰਦਾ ਐਡਵਾਂਸ ਦੇਖੋ ਭਾਅ ਜੀ ਦੋਨਾਂ ਦਾ ਪੰਦਰਾਂ ਪੰਦਰਾਂ ਸੌ ਪਾ ਦੋ ਬਸ ਹਾਂਜੀ ਹਾਂਜੀ ਹਾਂਜੀ ਤੁਹਾਡੇ ਕੋਲ ਨੰਬਰ ਤਾਂ ਉਹਦਾ ਹੋਣਾ ਜੀ ਤੁਹਾਡੇ ਕੋਲ ਦੁਕਾਨ ਦੇ ਕੋਂਟੈਕਟਸ ਵਗੈਰਾ ਤੁਸੀਂ ਆ ਕੇ ਤੁਹਾਡੇ ਨਾਲ ਫੋਨ ਇੱਥੇ ਮੰਗਵਾ ਕੇ ਰੱਖ ਦਾਂਗੇ ਅਤੇ ਤੁਸੀਂ ਆ ਕੇ ਲੈ ਜਿਓ ਠੀਕ ਹੈ ਜੀ ਜ਼ਰੂਰ ਜ਼ਰੂਰ ਜ਼ਰੂਰ ਓਕੇ ਭਾਅ ਜੀ ਧੰਨਵਾਦ